ਸੋਚਦਾ ਹਾਂ ਪੀ ਸਰਕਾਰ ਨੂੰ ਅੱਗੇ ਵਧਾਉਣ ਵਾਸਤੇ ਹੋਰ ਪੈਸਾ ਦੇਣਾ ਚਾਹੀਦਾ ਹੈ ਜਿਵੇਂ ਸਾਡੇ ਪਿੰਡਾਂ ਵਿੱਚ ਕਈ ਤਰ੍ਹਾਂ ਦੀਆਂ ਗਰੋਂਡਾਂ ਹਨ ਉੱਥੇ ਵਧੀਆ ਪਲੇਅਰ ਦੇਣੇ ਚਾਹੀਦੇ ਹਨ ਕਿਉਂਕਿ ਜਿਵੇਂ ਫੁੱਟਬਾਲ ਦੀ ਗੇਮ ਹੋ ਗਈ ਕਬੱਡੀ ਦੀ ਹੋ ਗਈ ਅਤੇ ਕ੍ਰਿਕਟ ਦੀ ਹੋ ਗਈ ਕਿਉਂਕਿ ਸਾਨੂੰ ਉੱਥੇ ਵਧੀਆ ਕੋਚ ਦਿੱਤੇ ਜਾਣ ਅਤੇ ਵਧੀਆ ਗੇਮਾਂ ਕਰਵਾਈਆਂ ਜਾਣ ਹਾਂਜੀ ਜੇ ਕਿਤੇ ਸਾਨੂੰ ਮੌਕਾ ਮਿਲੇ ਤਾਂ ਅਸੀਂ ਵੱਧ ਤੋਂ ਵੱਧ ਪਲੇਅਰ ਤਿਆਰ ਕੀਤੇ ਜਾ ਜਾਂਦੇ ਹਨ ਅਤੇ ਬਾਅਦ ਵਿੱਚ ਅਸੀਂ ਉਹਨਾਂ ਨੂੰ ਪਲੇਅਰਾਂ ਨੂੰ ਤਿਆਰ ਕਰਾ ਕੇ ਟੂਰਨਾਮੈਂਟ ਕਰਵਾਈਏ ਟੂਰਨਾਮੈਂਟਾਂ 'ਤੇ ਸਰਕਾਰ ਨੂੰ ਕਿੱਟਾਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਵੱਧ ਤੋਂ ਵੱਧ ਪਲੇਅਰ ਤਿਆਰ ਹੋਣ ਉਹਨਾਂ ਵਿੱਚੋਂ ਦਸ ਬਾਰ੍ਹਾਂ ਪਲੇਅਰਾਂ ਵਿੱਚੋਂ ਤਿਆਰ ਕਰਕੇ ਫੇਰ ਸਾਨੂੰ ਉਹਨਾਂ ਦੇ ਆਪਸ ਵਿੱਚ ਮੈਚ ਕਰਵਾਉਣਾ ਚਾਹੀਦਾ ਹੈ ਮੈਚ ਕਰਾ ਕੇ ਬਾਅਦ 'ਚ ਵਿੱਚ ਉਹਨਾਂ ਦਾ ਟੂਰਨਾਮੈਂਟ ਕਰਾ ਕੇ ਅਤੇ ਇਨਾਮ ਦੇ ਕੇ ਉਹਨਾਂ ਦੀ ਹੋਂਸਲਾ ਵਧਾਈ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਤੋਂ ਵੱਧ ਤੋਂ ਵੱਧ ਪਲੇਅਰ ਤਿਆਰ ਹੋਣ ਇਸ ਲੀਏ ਮੈਨੂੰ ਚਾਹੀਦਾ ਹੈ ਕਿ ਜਿਵੇਂ ਕੋਈ ਵੀ ਪਲੇਅਰ ਤਿਆਰ ਹੁੰਦਾ ਹੈ ਤੋ ਤੋ ਵੱਧ ਵੱਧ ਖਰਚਾ ਲਾ ਕੇ ਉਹਨਾਂ 'ਤੇ ਲਾ ਕੇ ਟੀਮਾਂ ਨੂੰ ਲਿਆ ਕੇ ਸਾਨੂੰ ਆਪਣੀਆਂ ਖੇਡਾਂ ਨੂੰ ਬਾਹਰ ਲੈ ਕੇ ਜਾਣਾ ਚਾਹੀਦਾ ਹੈ ਜਦੋਂ ਅਸੀਂ ਬਾਹਰ ਲੈ ਕੇ ਜਾਈਏ ਅਤੇ ਉਹ ਇਨਾਮ ਲੈ ਕੇ ਆਉਣ ਤਾਂ ਸਾਡੇ ਪੰਜਾਬ ਦਾ ਨਾਂ ਵੱਧ ਤੋਂ ਵੱਧ ਵਧਣਾ ਚਾਹੀਦਾ ਹੈ